ਸਤਿ ਸ਼੍ਰੀ ਅਕਾਲ ਸਰ ਮੈਂ ਮੀਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਅਤੇ ਸਾਡੇ ਪੰਜਾਬ ਵਿੱਚ ਤ ਚਾਰ ਤਰ੍ਹਾਂ ਦੀ ਭਾਸ਼ਾ ਪੰਜਾਬੀ ਬੋਲੀ ਜਾਂਦੀ ਹੈ ਕਿ ਜਿਵੇਂ ਕਿ ਸਭ ਨੂੰ ਪਤਾ ਕਿ ਪੰਜਾਬੀ ਮਾਂ ਸਾਡੀ ਮਾਂ ਬੋਲੀ ਆ ਸਾਨੂੰ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਸਿਖਾਉਣੀ ਚਾਹੀਦੀ ਹੈ ਅਤੇ ਜ ਜੇਕਰ ਅਸੀਂ ਬਾਹਰ ਕਿਸੇ ਨਾਲ ਗ ਪੰਜਾਬੀ ਵਿੱਚ ਗੱਲ ਕਰੀਏ ਤਾਂ ਸਾਨੂੰ ਆਪਣਾਪਨ ਜਿਹਾ ਮਹਿਸੂਸ ਹੁੰਦਾ ਹੈ ਅਤੇ ਜੇਕਰ ਅਸੀਂ ਕਿਸੇ ਹੋਰ ਨਵੀਂ ਥਾਂ ਜਾਈਏ ਬਾਹਰ ਜਿਵੇਂ ਅੰਮ੍ਰਿਤਸਰ ਜਲੰਧਰ ਵਗੈਰਾ ਅਤੇ ਉਹ ਆਪਣੀ ਭਾਸ਼ਾ ਵਿੱਚ ਗੱਲ ਕਰਦੇ ਹੈ ਅਤੇ ਸਾਨੂੰ ਸਾਡੀ ਬੋਲੀ ਦਾ ਅਨੁਭਵ ਕਰਵਾਉਂਦੇ ਹਨ ਅਤੇ ਸਾਨੂੰ ਆਪਣਾਪਨ ਮਹਿਸੂਸ ਹੁੰਦਾ ਹੈ ਅਤੇ ਪੰਜਾਬੀ ਪੰਜਾਬ ਵਿੱਚ ਚਾਰ ਤਾਂ ਕਈ ਤੇ ਤਰ੍ਹਾਂ ਦੀ ਪੰਜਾਬੀ ਬੋਲੀ ਜਾਂਦੀ ਹੈ ਜਿਵੇਂ ਦੁਆਬੀ ਹੋਰ ਕਈ ਤਰ੍ਹਾਂ ਦੀਆਂ ਪੰਜਾਬੀਆਂ ਪੰਜਾਬੀ ਬੋਲੀ ਜਾਂਦੀ ਹੈ ਕਿਸ ਕਾਰਣ ਸਾਨੂੰ ਹਰ ਤਰ੍ਹਾਂ ਦੀ ਭਾਸ਼ਾ ਦਾ ਅਨੁਭਵ ਹੁੰਦਾ ਹੈ ਅਤੇ ਨਵੀਂ ਨਵੀਂ ਗੱਲਾਂ ਦਾ ਅਤੇ ਨਵੇਂ ਨਵੇਂ ਭਾਸ਼ਾਵਾਂ ਦਾ ਭਾਸ਼ਾਵਾਂ ਬਾਰੇ ਪਤਾ ਲੱਗਦਾ ਹੈ ਪੰਜਾਬੀ